ਮੈਂ ਮੋਬਾਈਲ ਆਪਰੇਟਰ ਦੀ ਵੈਬਸਾਈਟ ਵੇਖ ਰਹੀ ਹਾਂ ਮੈਂ ਆਪਣੇ ਬਜਟ ਦੇ ਅੰਦਰ ਯੋਜਨਾ ਲੱਭਣ ਬਾਰੇ ਚਰਚਾ ਕਰ ਰਹੀ ਹਾਂ ਮੈਂ ਬੀ ਐਸ ਐਨ ਐਲ ਦੀ ਯੋਜਨਾ ਲੱਭ ਰਹੀ ਹਾਂ ਤਾਂ ਕਿ ਕੋਈ ਸਸਤੀ ਜਿਹੀ ਯੋਜਨਾ ਹੋਏ ਜੋ ਮੇਰੇ ਕੰਮ ਵੀ ਆ ਸਕੇ ਅਤੇ ਬਜਟ ਦੇ ਅੰਦਰ ਹੋਏ ਤਾਂ ਮੈਨੂੰ ਲੱਭਦੇ ਸਮੇਂ ਇੱਕ ਮੇਰੇ ਬਜਟ ਦੇ ਅੰਦਰ ਹੀ ਯੋਜਨਾ ਮਿਲੀ ਜੋ ਡੇਢ ਸੌ ਰੁਪਏ ਦਾ ਰਿਚਾਰਜ ਹੈ